ਸਿੱਖਿਆ ਪ੍ਰਣਾਲੀ ਦੇ ਵਿੱਚ ਸਟੇਟ ਇੱਕ ਆਪਦੀ ਵੱਡੀ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਜਿਹੜਾ ਇੱਕ ਵਿਦਿਆਰਥੀ ਹੁੰਦਾ ਉਹਨੇ ਆਪਦੀ ਮੁੱਢਲੀ ਸਿੱਖਿਆ ਤਾਂ ਆਪਦੀ ਸਟੇਟ 'ਚੋਂ ਹੀ ਲੈਣੀ ਹੁੰਦੀ ਹੈ ਇਸ ਕਰਕੇ ਅਗਰ ਸਟੇਟ ਦੀਆਂ ਸੰਸਥਾਵਾਂ ਉਹਨਾਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨ ਦੇ ਵਿੱਚ ਮੱਦਦ ਕਰਦੀਆਂ ਹਨ ਤਾਂ ਉਹ ਵਿਦਿਆਰਥੀ ਅੱਗੇ ਜਾ ਕੇ ਦੇਸ਼ ਦੇ ਲਈ ਬਹੁਤ ਵਧੀਆ ਯੋਗਦਾਨ ਪ੍ਰਦਾਨ ਕਰ ਸਕਦਾ ਹੈ ਇਸ ਕਰਕੇ ਸਟੇਟ ਲੈਵਲ 'ਤੇ ਬਹੁਤ ਵਧੀਆ ਵਧੀਆਂ ਸੰਸਥਾਵਾਂ ਬਣੀਆਂ ਹੋਈਆਂ ਹਨ ਜਿਹੜੀਆਂ ਕਿ ਬੱਚਿਆਂ ਦੀਆਂ ਪ੍ਰਭਾਵਸ਼ਾਲੀ ਕਹਿ ਦਈਏ ਪ੍ਰਭਾਵ ਨੂੰ ਉਭਾਰਨ ਦੇ ਵਿੱਚ ਮੱਦਦ ਕਰਦੀਆਂ ਹਨ ਇਹੋ ਜਿਹੀ ਸੰਸਥਾਵਾਂ ਕਈ ਬੱਚੇ ਇਹੋ ਜਿਹੇ ਹੁੰਦੇ ਹਨ ਜਿੰਨਾਂ ਦੇ ਵਿੱਚ ਅਥਾਹ ਸਕਿੱਲ ਹੁੰਦਾ ਹੈ ਜਿਹਨੂੰ ਉਭਾਰਨ ਵਾਸਤੇ ਉਹਨਾਂ ਨੂੰ ਕਿਸੇ ਦੀ ਲੋੜ ਪੈਂਦੀ ਹੈ ਇਸ ਕਰਕੇ ਜਿਹੜੀਆਂ ਸਟੇਟ ਆਪਦੇ ਪੱਧਰ 'ਤੇ ਸੰਸਥਾਵਾਂ ਬਣਾਉਂਦਾ ਉਹਨਾਂ ਸੰਸਥਾਵਾਂ ਦੇ ਸਹਾਰੇ ਅਸੀਂ ਆਪਦੇ ਬੱਚੇ ਨੂੰ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਵਿਕਾਸ ਹੁੰਦਾ ਦੇਖ ਸਕਦੇ ਹਨ ਇਹਦੇ ਨਾਲ ਕੀ ਹੁੰਦਾ ਹੈ ਕਿ ਬੱਚੇ ਦੇ ਗਿਆਨ ਦੇ ਵਿੱਚ ਅਥਾਹ ਵਾਧਾ ਹੁੰਦਾ ਹੈ ਕਿਉਂਕਿ ਅਗਰ ਅਸੀਂ ਕਹੀਏ ਕਿ ਕਿਤਾਬਾਂ ਸਾਨੂੰ ਸਾਰਾ ਕੁਛ ਦੇ ਸਕਦੀਆਂ ਹਨ ਤਾਂ ਨਹੀਂ ਉਸ ਇਸ ਵਾਸਤੇ ਉਹ ਉਹ ਬੱਚਿਆਂ ਨੂੰ ਕੁਛ ਹੋਰ ਚੀਜ਼ਾਂ ਦੀ ਵੀ ਲੋੜ ਹੁੰਦੀ ਹੈ ਜਿਵੇਂ ਕਈ ਸੰਸਥਾਵਾਂ ਜਾਂ ਕਹਿ ਦਈਏ ਕਈ ਕੰਪਨੀਆਂ ਹੁੰਦੀਆਂ ਹਨ ਜਿਹੜੀਆਂ ਬੱਚਿਆਂ ਵਾਸਤੇ ਅੱਡ ਅੱਡ ਤਰ੍ਹਾਂ ਦੀਆਂ ਸਕੀਮਾਂ ਬਣਾਉਂਦੀਆਂ ਹਨ ਜਿਸ ਵਿੱਚ ਬੱਚਿਆਂ ਦੇ ਵਿਕਾਸ ਨੂੰ ਪ੍ਰੋਤਸ਼ਾਹਿਤ ਕਰਨ ਵਾਸਤੇ ਅੱਡ ਅੱਡ ਤਰ੍ਹਾਂ ਦੇ ਕੰਪੀਟੀਸ਼ਨ ਰੱਖੇ ਜਾਂਦੇ ਹਨ ਜਿੰਨਾਂ ਦੇ ਸਹਾਰੇ ਬੱਚੇ ਬਹੁਤ ਸਾਰੀ ਆਪਦੀ ਗਿਆਨ ਦੇ ਵਿੱਚ ਵਾਧਾ ਕਰ ਸਕਦੇ ਹਨ